ਮੇਰੀ ਪਹਿਲੀ ਡਰੋਇੰਗ ਅਨੁਭਵ ਦੀ ਗੱਲ ਕਰੀਏ ਤਾਂ ਇਹ ਬਚਪਨ 'ਚੋ ਹੀ ਸ਼ੁਰੂ ਹੋ ਗਿਆ ਸੀ ਸ਼ਾਇਦ ਸਭ ਤੋਂ ਪਹਿਲੀ ਯਾਦ ਉਹ ਸਮਾਂ ਹੈ ਜਦ ਮੈਂ ਕੋਪੀ ਅਤੇ ਪੇਪਰ 'ਤੇ ਸਧਾਰਨ ਰੇਖਾਵਾਂ ਬਣਾਉਂਦਿਆਂ ਆਪਣੇ ਮਨ ਦੀ ਦੁਨੀਆਂ ਵਿਖ ਰਿਹਾ ਸੀ ਸ਼ੁਰੂਆਤ 'ਚ ਇਹ ਕੇਵਲ ਲਕੀਰ ਗੋਲ ਅਕਾਰ ਅਤੇ ਬਿਹਤਰਤੀ ਰੂਪ ਵਿੱਚ ਪਰ ਉਹਨਾਂ ਵਿੱਚ ਮੇਰੀ ਰਚਨਾ ਆਤਮਕਤਾ ਦੇ ਚਮਕ ਸ਼ਾਮਿਲ ਸੀ ਮੈਨੂੰ ਡਰਾਇੰਗ ਕਰਨ ਦੀ ਪ੍ਰੇਰਨਾ ਬਥੇਰੇ ਕਾਰਟੂਨ ਕਹਾਣੀਆਂ ਦੀਆਂ ਕਿਤਾਬਾਂ ਅਤੇ ਨੇਚਰ ਤੋਂ ਮਿਲੀ ਜਦੋਂ ਮੈਂ ਜਦੋਂ ਵੀ ਮੈਂ ਕਿਸੇ ਚੀਜ਼ ਨੂੰ ਵੇਖਦਾ ਮੈਂ ਸੋਚਦਾ ਕਿ ਕੀ ਮੈਂ ਇਸ ਨੂੰ ਆਪਣੇ ਹੱਥ ਨਾਲ ਕਾਗਜ਼ 'ਤੇ ਉਤਾਰ ਸਕਦਾ ਹਾਂ ਇਹ ਉਤਸਾਹੀ ਦ੍ਰਿਸ਼ਟੀਕੋਣ ਮੈਨੂੰ ਹਰ ਨਵੇਂ ਪਾਸੋਂ ਖਿੱਚਦਾ ਗਿਆ ਮੈਂ ਪਹਿਲੀ ਵਾਰ ਗੰਭੀਰਤਾ ਨਾਲ ਡਰੋਇੰਗ ਕਰਨੀ ਸ਼ੁਰੂ ਕੀਤੀ ਜਦੋਂ ਮੈਂ ਇੱਕ ਪਸੰਦੀਦਾ ਕਾਰਟੂਨ ਕਿਰਦਾਰ ਸਾਹਿਤ ਟੋਮ ਐਂਡ ਜੈਰੀ ਜਾਂ ਚਿੱਤਰਲੇਖੀ ਸ਼ਕਲ ਬਣਾਉਣ ਦੀ ਕੋਸ਼ਿਸ਼ ਕੀਤੀ ਇਹ ਬਹੁਤ ਆਮ ਪਰ ਮੇਰੇ ਲਈ ਖਾਸ ਤਜੁਰਬਾ ਸੀ ਉਹ ਲਾਈਨ ਭਾਵੇਂ ਬਹੁਤ ਆਕਰਸ਼ਕ ਨਹੀਂ ਸਾ ਪਰ ਉਹ ਮੇਰੇ ਲਈ ਸਿਪਾਹੀ ਹੋਣ ਦੀ ਭਾਵਨਾ ਨੂੰ ਜਨਮ ਦੇ ਰਹੀ ਹੈ ਸਨ ਮੈਨੂੰ ਅਜੇ ਵੀ ਯਾਦ ਹੈ ਕਿ ਮੈਂ ਜਦੋਂ ਪਹਿਲੀ ਵਾਰ ਇੱਕ ਚਿੱਤਰ